ਮੇਰੀ ਕਾਰ ਲਏ ਨੂੰ ਕੁਝ ਕੁ ਮਹੀਨੇ ਹੋਏ ਸੀ ਅਤੇ ਉਹ ਜਿਹੜੀ ਮੇਰੀ ਕਾਰ ਸੀ ਉਹਦੀਆਂ ਸੀਟਾਂ ਵੀ ਫੱਟਣ ਲੱਗ ਪਈਆਂ ਨੇ ਅਤੇ ਉਹਦੀ ਕਾਰ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਅਤੇ ਮੈਂ ਇੱਕ ਵਾਰ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਰਹੀ ਸੀ ਅਤੇ ਜਦੋਂ ਮੈਂ ਉੱਥੇ ਗਈ ਤਾਂ ਮੈਂ ਉੱਥੇ ਜਾ ਕੇ ਦੇਖਿਆ ਕਿ ਮੇਰੀ ਕਾਰ ਦਾ ਟਾਇਰ ਪੰਚਰ ਹੋ ਚੁੱਕਿਆ ਸੀ ਅਤੇ ਜਦੋਂ ਮੈਂ ਵਾਪਸ ਆਈ ਤਾਂ ਮੈਨੂੰ ਉੱਥੇ ਕੋਈ ਟਾਇਰ ਪੰਚਰ ਵਾਲੀ ਦੁਕਾਨ ਵੀ ਨਹੀਂ ਮਿਲੀ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਅਤੇ ਫਿਰ ਜਿਹੜੀ ਮੇਰੀ ਕਾਰ ਹੈ ਉਹ ਕਾਰ ਦਾ ਹੋਰਨ ਵੀ ਸਹੀ ਤਰ੍ਹਾਂ ਤਰੀਕੇ ਨਾਲ ਕੰਮ ਨਹੀਂ ਕਰਦਾ ਜਿਸ ਕਰਕੇ ਰਾਤ ਨੂੰ ਪਰੇਸ਼ਾਨੀ ਆਉਂਦੀ ਹੈ ਜਦੋਂ ਕਿਤੇ ਸਫ਼ਰ ਦੇ ਲਈ ਜਾਂਦੇ ਹਾਂ ਤਾਂ ਇਸ ਕਰਕੇ ਇਹ ਦੇਖ ਕੇ ਮੈਂ ਬਹੁਤ ਹੀ ਜ਼ਿਆਦਾ ਕਾਰ ਦੀ ਹਾਲਤ ਦੇਖ ਕੇ ਮੈਂ ਦੁਖੀ ਹੋ ਚੁੱਕੀ ਸੀ